ਜਿੱਦਾਂ ਕਿ ਮੈਂ ਪੋਸਟ ਗ੍ਰੇਜੂਏਸ਼ਨ ਸ਼ਸ਼ੋਲਜੀ ਵਿੱਚ ਕਰ ਰਹੀ ਹਾਂ ਇਹ ਮੇਰਾ ਵਿਸ਼ਾ ਹੈ ਕਿ ਮੈਂ ਗਰੀਬੀ ਅਸਮਾਨਤਾ ਵਿਤਕਰੇ ਬਾਰੇ ਪੜ੍ਹਦੀ ਹਾਂ ਸਾਡੇ ਸਮਾਜ ਵਿੱਚ ਗਰੀਬੀ ਬਹੁਤ ਹੀ ਜ਼ਿਆਦਾ ਪਾਈ ਜਾਂਦੀ ਹੈ ਅਤੇ ਗਰੀਬ ਅਤੇ ਅਮੀਰ ਦਾ ਭੇਦਭਾਵ ਵੀ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ ਸਾਨੂੰ ਇਹ ਗਰੀਬੀ ਅਤੇ ਅਸਮਾਨਤਾ ਨੂੰ ਦੂਰ ਕਰਨ ਲਈ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਜੋ ਗਰੀਬ ਲੋਕ ਹਨ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੂੰ ਆਮਦਨੀ ਵੀ ਬਹੁਤ ਘੱਟ ਹੁੰਦੀ ਹੈ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਜੋ ਖ਼ਰਚਾ ਹੈ ਉਹ ਵੀ ਚੁੱਕ ਨਹੀਂ ਸਕਦੇ ਇਸ ਤੋਂ ਇਲਾਵਾ ਉਹਨਾਂ ਦੇ ਘਰ ਦਾ ਜੋ ਗੁਜ਼ਾਰਾ ਹੈ ਬਹੁਤ ਔਖਾ ਚੱਲਦਾ ਹੈ ਖਾਣ ਲਈ ਰੋਟੀ ਨਹੀਂ ਹੁੰਦੀ ਸਾਨੂੰ ਉਨ੍ਹਾਂ ਲਈ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ